ਕਿਫਾਇਤੀ ਆਵਾਜਾਈ ਦੀ ਘਾਟ ਨੇ ਸ਼ਹਿਰਾਂ ਜਾਂ ਕਸਬਿਆਂ ਵਿੱਚ ਸੰਭਾਲ ਸਿੱਖਿਆ ਨੌਕਰੀਆਂ ਦੇ ਵਿੱਚ ਬਹੁਤ ਪ੍ਰਭਾਵਿਤ ਕੀਤਾ ਜਿਵੇਂ ਮੰਨ ਕੇ ਚੱਲ ਲਾ ਲਉ ਵੀ ਜਿਵੇਂ ਸਿੱਖਿਆ ਲਈ ਜਿਵੇਂ ਜਿਵੇਂ ਅਸੀਂ ਇੱਕ ਪਿੰਡ ਜਾਂ ਛੋਟੇ ਕਸਬੇ 'ਚ ਰਹਿੰਦੇ ਹਾਂ ਸ਼ਹਿਰ ਤੋਂ ਕਾਫੀ ਦੂਰ ਆ ਇਸ ਲਈ ਜੋ ਜਿਵੇਂ ਰੋਜ਼ਾਨਾ ਆਉਣ ਜਾਣ ਦੇ ਵਿੱਚ ਬਹੁਤ ਜ਼ਿਆਦਾ ਪੈਸੇ ਖਰਚ ਹੁੰਦੇ ਆ ਜਿਹੜੇ ਰੋਜ਼ਾਨਾ ਰੋਜ਼ਾਨਾ ਬਸ ਰੋਜ਼ਾਨਾ ਜਾਇਆ ਜਾਵੇ ਤਾਂ ਇਸ ਲਈ ਜਿਵੇਂ ਮੰਨ ਕੇ ਚੱਲੋ ਵੀ ਨੌਕਰੀ ਪ੍ਰਾਪਤ ਕਰਨ ਲਈ ਜਿਵੇਂ ਵੱਡੇ ਸ਼ਹਿਰਾਂ ਵਿੱਚ ਜਾਣਾ ਪੈਂਦਾ ਉਸ ਲਈ ਜਿਵੇਂ ਹੁਣ ਦਿੱਲੀ ਸ਼ਹਿਰ ਆ ਉਸ 'ਚ ਆਉਣ ਜਾਣ ਲਈ ਬਹੁਤ ਜ਼ਿਆਦਾ ਪੈਸਾ ਖਰਚ ਕੀਤਾ ਹੋ ਜਾਂਦਾ ਇਸ ਲਈ ਜਿਵੇਂ ਹੁਣ ਨੌਕਰੀ ਦੀ ਭਾਲ ਤਾਂ ਹੈ ਲੇਕਿਨ ਪਰ ਜਾਇਆ ਨਹੀਂ ਜਾਂਦਾ ਰੋਜ਼ਾਨਾ ਇੰਨੀ ਦੂਰ ਉਸ ਤਰ੍ਹਾਂ ਹੀ ਜਿਵੇਂ ਸੇ ਆਪਣੀ ਸਿਹਤ ਸੰਭਾਲ ਆ ਸਿਹਤ ਸੰਭਾਲਣ ਜਿਵੇਂ ਕੋਈ ਬਿਮਾਰ ਹੋ ਜਾਂਦਾ ਬੰਦਾ ਜਿਵੇਂ ਪਿੰਡਾਂ ਦੇ ਵਿੱਚ ਆ ਹੈ ਨਾ ਸ਼ਹਿਰਾਂ ਤੋਂ ਦੂਰ ਵੀ ਉਸ ਲਈ ਜਿਵੇਂ ਕੋਈ ਜਿਵੇਂ ਸਪੈਸ਼ਲ ਕੋਈ ਵਹੀਕਲ ਕੀਤਾ ਜਾਵੇ ਤਾਂ ਉਹਦੇ ਲਈ ਬਹੁਤ ਜ਼ਿਆਦਾ ਖਰਚਾ ਆਉਂਦਾ ਇਸ ਲਈ ਇਹ ਸਿਹਤ ਕੋਈ ਐਮਰਜੈਂਸੀ ਹੋ ਗਈ ਜਿਵੇਂ ਮਰੀਜ਼ ਨੂੰ ਇਸ ਜਿਵੇਂ ਉਹਨੂੰ ਐਮਰਜੈਂਸੀ ਲਿਜਾਣ ਲਈ ਬਹੁਤ ਜ਼ਿਆਦਾ ਪੈਸਾ ਖਰਚਿਆ ਜਾਂਦਾ ਹੈ ਇਸ ਲਈ ਬਹੁਤ ਜ਼ਿਆਦਾ ਮੁਸ਼ਕਲ ਹੁੰਦੀ ਆ ਸਿਹਤ ਨੂੰ ਸੰਭਾਲਣ ਲਈ ਵੀ ਸਿੱਖਿਆ ਲਈ ਵੀ ਇਹੀ ਆ ਵੀ ਬਾਹਰ ਜਾ ਕੇ ਉੱਥੇ ਜਾ ਕੇ ਰਹਿ ਕੇ ਪੜ੍ਹਨਾ ਪੈਂਦਾ ਕਿਸੇ ਵੀ ਕਾਲਜ ਜਾਂ ਸਕੂਲ ਦੇ ਵਿੱਚ ਅਤੇ ਉੱਥੇ ਰਹਿਣ ਦੇ ਵਿੱਚ ਬਹੁਤ ਜ਼ਿਆਦਾ ਖਰਚਾ ਆ ਜਾਂਦਾ ਅਤੇ